ਮੇਰੀ ਜਨਮ ਤਰੀਕ ਚਾਰ ਅਪ੍ਰੈਲ ਉੱਨੀ ਸੌ ਅੱਸੀ ਮੇਰੀ ਪਤਨੀ ਦੀ ਜਨਮ ਤਰੀਕ ਛੇ ਜੂਨ ਉੱਨੀ ਸੌ ਬਿਆਸੀ ਮੇਰੇ ਵਿਆਹ ਦੀ ਤਰੀਕ ਛੱਬੀ ਜੂਨ ਉੱਨੀ ਸੌ ਅਠਾਰ੍ਹਾਂ ਮੇਰੇ ਸਕੂਲ ਜੁਆਇਨ ਕਰਨ ਦੀ ਤਰੀਕ ਇੱਕ ਨਵੰਬਰ ਦੋ ਹਜ਼ਾਰ ਸੋਲ਼੍ਹਾਂ ਅਤੇ ਮੇਰੀ ਭੈਣ ਦੀ ਜਨਮ ਤਰੀਕ ਛੇ ਚਾਰ ਦਸੰਬਰ ਉੱਨੀ ਸੌ ਉਨਾਸੀ